ਅਸੀਂ ਆਪਣੇ ਆਲੇ ਦੁਆਲੇ ਇਲਾਕੇ ਨੂੰ ਸਾਫ ਰੱਖਣ ਲਈ ਬਹੁਤ ਹੀ ਬਹੁਤ ਵੱਡੇ ਉਪਾਏ ਅਤੇ ਯੋਗਦਾਨ ਵੀ ਕਰਦੇ ਹਨ ਅਤੇ ਸਾਡਾ ਇਹ ਫਰਜ਼ ਵੀ ਬਣਦਾ ਹੈ ਕਿ ਅਸੀਂ ਆਪਣੇ ਘਰ ਅਤੇ ਆਲੇ ਦੁਆਲੇ ਨੂੰ ਸਾਫ ਰੱਖਣ ਲਈ ਇੱਕ ਆਪਣਾ ਯੋਗਦਾਨ ਜ਼ਰੂਰ ਦਿੱਤਾ ਜਾਵੇ ਸਾਡੀ ਸੋਸਾਇਟੀ ਦੇ ਵਿੱਚ ਇਸ ਲਈ ਖਾਸ ਤੌਰ 'ਤੇ ਧਿਆਨ ਵੀ ਦਿੱਤਾ ਜਾਂਦਾ ਹੈ ਸਾਡੀ ਸੁਸਾਇਟੀ ਵਿੱਚ ਸਾਡੇ ਕਮੇਟੀ ਮੈਂਬਰਾਂ ਦੁਆਰਾ ਇੱਕ ਟੀਮ ਬਣਾਈ ਗਈ ਹੈ ਜਿਹਨਾਂ ਦਾ ਕੰਮ ਸਾਡੀ ਸੁਸਾਇਟੀ ਦੇ ਆਲੇ ਦੁਆਲੇ ਨੂੰ ਸਾਫ ਰੱਖਣ ਦਾ ਹੈ ਸਾਡੀ ਉਹ ਉਹ ਟੀਮ ਦਾ ਕੰਮ ਸਵੇਰੇ ਨੌਂ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਹੁੰਦਾ ਹੈ ਅਤੇ ਰਾਤ ਵਾਸਤੇ ਅਲੱਗ ਟੀਮ ਤਿਆਰ ਕੀਤੀ ਗਈ ਹੈ ਅਤੇ ਉਸ ਵਿੱਚ ਕਮੇਟੀ ਦੁਆਰਾ ਟ ਸਮੇਂ ਸਮੇਂ ਅਨੁਸਾਰ ਲੋਕਾਂ ਤੋਂ ਆਪਣੀ ਸੋਸਾਇਟੀ ਦੇ ਮੈਂਬਰਾਂ ਨੂੰ ਜੋ ਸਫਾਈ ਦੇ ਪ੍ਰਤੀ ਜਾਗਰੂਕ ਕਰਨ ਲਈ ਕਈ ਗਰੁੱਪ ਮੀਟਿੰਗਾਂ ਵੀ ਕੀਤੀ ਜਾਂਦੀਆਂ ਜਿਸ ਵਿੱਚ ਲੋਕਾਂ ਦੁਆਰਾ ਫੀਡਬੈਕ ਵੀ ਲਿਆ ਜਾਂਦਾ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੀ ਸਸਾਈ ਸੋਸਾਇਟੀ ਨੂੰ ਹੋਰ ਬਿਹਤਰ ਬਣਾ ਸਕੀਏ ਅਤੇ ਆਪਣੇ ਆਲੇ ਦੁਆਲੇ ਨੂੰ ਹੋਰ ਵਧੀਆ ਤਰੀਕੇ ਨਾਲ ਸਾਂਭ ਸੰਭਾਲ ਸਫਾਈ ਨਾਲ ਸਾਂਭ ਸੰਭਾਲ ਕਰ ਸਕੇ ਸਾਡੀ ਸੋਸਾਇਟੀ ਵਿੱਚ ਵਾਤਾਵਰਨ ਨੂੰ ਬਚਾਉਣ ਲਈ ਵੀ ਨਵੇਂ ਤੋਂ ਨਵੇਂ ਰੁੱਖ ਲਗਾਏ ਜਾਂਦੇ ਹਨ ਅਤੇ ਹਰ ਸਾਲ ਵਿੱਚ ਇੱਕ ਵਾਤਾਵਰਨ ਦਿਵਸ ਦਿਵਸ ਵਾਲੇ ਦਿਨ ਸਾਡੀ ਸੋਸਾਇਟੀ ਦੁਆਰਾ ਇੱਕ ਫੰਡ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਜਿੱਥੇ ਜਿੱਥੇ ਵੀ ਸਾਨੂੰ ਜ਼ਰੂਰਤ ਲੱਗਦੀ ਹੈ ਕਿ ਇੱਥੇ ਰੁੱਖ ਹੋਣਾ ਚਾਹੀਦਾ ਤਾਂ ਅਸੀਂ ਉੱਥੇ ਰੁੱਖ ਵੀ ਲਗਾ ਲਗਵਾਉਣ ਜਾਂਦੇ ਹਨ ਸਾਡੀ ਸੋਸਾਇਟੀ ਵਿੱਚ ਵੱਖ ਵੱਖ ਤਰ੍ਹਾਂ ਦੇ ਕੂੜੇਦਾਨ ਲੱਗੇ ਹਨ ਜਿਸ ਵਿੱਚ ਗਿੱਲਾ ਗਿੱਲਾ ਸੁੱਕਾ ਕੂੜਾ ਜਿਹੜਾ ਅਲੱਗ ਕੀਤਾ ਜਾਂਦਾ ਹੈ ਜਿਹੜਾ ਕਿ ਕਦੇ ਵੀ ਯੂਸ ਨਹੀਂ ਕੀਤਾ ਜਾ ਸਕਦਾ ਉਹਨਾਂ ਵਾਸਤੇ ਅਲੱਗ ਕੂੜੇਦਾਨ ਬਣਾਏ ਗਏ ਹਨ ਰੀਸਾਈਕਲ ਲਈ ਵੀ ਰਿਕਵਰੀ ਲਈ ਵੀ ਬ ਅਲੱਗ ਅਲੱਗ ਕੂੜੇਦਾਨ ਜਿਹੜੇ ਹੈ ਬਣਾਏ ਗਏ ਹਨ ਇਸ ਵਿੱਚ ਹਰ ਮਹੀਨੇ ਜੋ ਹੈ ਬੱਚਿਆਂ ਦੇ ਮਾਪਿਆਂ ਨਾਲ ਵੀ ਗੱਲਾਂ ਕੀਤੀਆਂ ਜਾਂਦੀਆਂ ਹਨ ਅਤੇ ਉਹਨਾਂ ਨੂੰ ਦੱਸਿਆ ਜਾਂਦਾ ਕਿ ਆਪਣੇ ਬੱਚਿਆਂ ਨੂੰ ਕਿਵੇਂ ਤੁਸੀਂ ਸਿਖਾ ਸਕਦੇ ਹੋ ਕਿ ਸਫਾਈ ਕਿਵੇਂ ਰੱਖਣੀ ਹੈ ਸਫਾਈ ਸਾਡੇ ਜੀਵਨ ਲਈ ਸਮਾਜ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅਗਰ ਤੁਸੀਂ ਸਫਾਈ ਨਹੀਂ ਰੱਖੋਗੇ ਤਾਂ ਤੁਸੀਂ ਖੁਦ ਹੀ ਬਿਮਾਰ ਹੋਵੋਗੇ ਅਤੇ ਜਿਸ ਨਾਲ ਤੁਸੀਂ ਕਮਜ਼ੋਰ ਹੋਵੋਗੇ ਅਤੇ ਤੁਹਾਡੀ ਸੋਚਣ ਦੀ ਸ਼ਕਤੀ ਆਉਣ ਵਾਲੇ ਟਾਈਮ 'ਚ ਤੁਹਾਡੇ ਕੋਈ ਹੋਰ ਨਵੀਆਂ ਬਿਮਾਰੀਆਂ ਦਾ ਪੈਦਾਵਾਰ ਹੋਣਾ ਸਭ ਕੁਝ ਸਫਾਈ 'ਤੇ ਹੀ ਡਿਪੈਂਡ ਹੈ ਇਸ ਲਈ ਸਾਨੂੰ ਵੱਧ ਤੋਂ ਵੱਧ ਸਫਾਈ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਜਿਸ ਨਾਲ ਸਾਡਾ ਵਾਤਾਵਰਨ ਸਾਡਾ ਸਮਾਜ ਅਤੇ ਅਸੀਂ ਵੀ ਸੇਫ ਰਹੀਏ ਅਤੇ ਇੱਕ ਵਧੀਆ ਬਿਹਤਰ ਲਾਈਫ ਜੀਏ